ਹਾਂਜੀ ਸਾਡੇ ਪੰਜਾਬੀ ਸੱਭਿਆਚਾਰ ਦੇ ਵਿਆਹ ਸੱਭਿਆਚਾਰ ਦੇ ਵਿੱਚ ਵਿਆਹ ਦੀ ਰਸਮ ਪੂਰੀ ਤਰ੍ਹਾਂ ਵਿਸਤਰਿਤ ਹੈਗੀ ਹੈ ਮ ਮਤਲਬ ਕਿ ਔਰਤ ਅਤੇ ਮਰਦ ਦਾ ਜਿਹੜਾ ਰਿਸ਼ਤਾ ਹੈਗਾ ਆ ਮਤਲਬ ਮਤਲਬ ਖਾਸ ਤੌਰ 'ਤੇ ਜਿਹੜਾ ਉਹਦਾ ਫਿਜ਼ੀਕਲ ਰਿਲੇਸ਼ਨ ਦਾ ਜਿਹੜਾ ਰਿਸ਼ਤਾ ਹੈਗਾ ਉਹਨੂੰ ਵਿਆਹ ਦੇ ਰੂਪ ਦੇ ਵਿੱਚ ਹੀ ਮਾਨਤਾ ਮਿਲਦੀ ਹੈ ਅਤੇ ਵਿਆਹ ਕਰਾਉਣ ਦੇ ਵਿੱਚ ਰਸਮਾਂ ਜਿਹੜੀਆਂ ਨੇ ਪਹਿਲੇ ਮੋਟੇ ਤੌਰ 'ਤੇ ਇਹ ਹੈ ਕਿ ਕੁੜੀ ਜਿਹੜੀ ਹੈਗੀ ਆ ਉਹ ਵਿਆਹ ਕੇ ਮੁੰਡੇ ਦੇ ਘਰ ਆਉਂਦੀ ਆ ਪਹਿਲੀ ਰਸਮ ਇਹ ਮਤਲਬ ਜਿਹੜੀ ਮੋਟੇ ਮੁੱਲ ਮੂਲ ਰੂਪ ਦੇ ਵਿੱਚ ਮੁੱਢ ਰੂਪ ਦੇ ਵਿੱਚ ਇਹ ਪਾਲਣਾ ਕੀਤੀ ਜਾਂਦੀ ਹੈ ਇਸ ਗੱਲ ਦੀ ਅਤੇ ਦੂਸਰਾ ਜਿਹੜਾ ਹੈਗਾ ਆ ਉਹ ਵਿਆਹ ਦੀਆਂ ਰਸਮਾਂ ਦੇ ਵਿੱਚ ਜਿਵੇਂ ਆਨੰਦ ਕਾਰਜ ਕੀਤੇ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਫੇਰੇ ਲਏ ਜਾਂਦੇ ਹੈਗੇ ਅਤੇ ਵਿਆਹ ਨੂੰ ਜਿਹੜਾ ਹੈਗਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਦੀ ਪ੍ਰਵਾਨਗੀ ਲੈ ਕੇ ਜਿਹੜਾ ਹੈਗਾ ਉਹ ਉਸ ਰਸਮ ਨੂੰ ਨਿਭਾਇਆ ਜਾਂਦਾ ਅਤੇ ਵਿਆਹ ਨੂੰ ਜਿਹੜਾ ਹੈਗਾ ਉਹ ਪਾਕ ਰਿਸ਼ਤਾ ਮੰਨਿਆ ਜਾਂਦਾ ਅਤੇ ਕੁੜੀ ਮੁੰਡੇ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਕੁੜੀ ਦੇ ਸੁਹਾਗ ਗਾਏ ਜਾਂਦੇ ਹੈ ਵਰੀ ਬਣਾਈ ਜਾਂਦੀ ਹੈ ਮੁੰਡੇ ਦੀ ਜਿਹੜੀ ਹੈਗੀ ਹੈ ਅਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਉਹ ਗਹਿਣਾ ਗੱਟਾ ਪਾਇਆ ਜਾਂਦਾ ਇਸ ਕਿਸਮ ਦੀਆਂ ਰਸਮਾਂ ਜਿਹੜੀਆਂ ਹੈਗੀਆਂ ਨੇ ਮੂਲ ਰੂਪ ਦੇ ਵਿੱਚ ਪ੍ਰਚਲਿਤ ਜਿਹੜੀਆਂ ਹੈਗੀਆਂ ਉਹ ਹੈਗੀਆਂ ਨੇ